ਬਾਈ ਤੁਸੀਂ ਮਾਨਸਾ ਕਾਲਜ ਚੋਂ ਗੱਲ ਕਰ ਰਹੇ ਲਖਵੀਰ ਗੱਲ ਕਰ ਰਹੇ ਹੋ ਬਾਈ ਮੈਨੂੰ ਕਿਸੇ ਨੇ ਨੰਬਰ ਦਿੱਤਾ ਸੀ ਵੀਰ ਤੁਹਾਡਾ ਅੱਛਾ ਬਾਈ ਤੁਸੀਂ ਹੋਸਟਲ 'ਚ ਰਹਿੰਦੇ ਹੋ ਬਾਈ ਮੈਂ ਵੀ ਲੱਗਣਾ ਹੋਸਟਲ 'ਚ ਰਹਿਣ ਲਈ ਆਉਣਾ ਵਾ ਉੱਥੇ ਦਾ ਮਾਹੌਲ ਕਿਵੇਂ ਆ ਬਾਈ ਲੜਾਈਆਂ ਤਾਂ ਨਹੀਂ ਹੁੰਦੀਆਂ ਬਾਈ ਅਤੇ ਖਾਣ ਪੀਣ ਬਾਈ ਗਰਾਉਂਡ ਗਰੂਉਂਡ ਹੈਗੇ ਹੈਗੇ ਗਰਾਉਂਡ ਵਗੈਰਾ ਹੈਗੇ ਉੱਥੇ ਅਤੇ ਉੱਥੇ ਦੀ ਫੀਸ ਕੀ ਹੈ ਬਾਈ ਉੱਥੇ ਮੈਡਮਾ ਦਾ ਸੁਭਾਅ ਵਧੀਆ ਗਾ ਬਾਈ ਇੱਕ ਕਮਰੇ 'ਚ ਬਾਈ ਕਿੰਨੇ ਰਹਿ ਸਕਦੇ ਨੇ ਠੀਕ ਹੈ ਬਾਈ ਕੋਈ ਨਹੀਂ ਮੈਂ ਆਊਂਗਾ ਵੀਰੇ ਮੈਨੂੰ ਈਜਿਲੀ ਅਜੈਸਟ ਕਰ ਲੈਣਗੇ ਮੈਨੂੰ ਇੱਥੇ ਆ ਕੇ ਕਿਹਦੇ ਨਾਲ ਗੱਲ ਕਰਨੀ ਪਊਗੀ ਠੀਕ ਹੈ ਜੀ